ਛੋਟੇ ਬੱਚੇ ਦੇ ਜਨਮ ਤੋਂ ਬਾਅਦ ਉਹਨੂੰ ਜਨਮ ਤੋਂ ਤੁੰਰਤ ਬਾਅਦ ਉਹਨੂੰ ਸਾਫ ਕਰਨਾ ਚਾਹੀਦਾ ਹੈ ਉਹਨੂੰ ਵੱਧ ਤੋਂ ਵੱਧ ਕੱਪੜੇ ਪਾਉਣੇ ਚਾਹੀਦੇ ਆ ਸਾਫ ਸੁਥਰੇ ਅਤੇ ਸੋਫਟ ਕੱਪੜਿਆਂ ਵਿੱਚ ਉਹਨੂੰ ਲਿਪਟਾਉਣਾ ਚਾਹੀਦਾ ਹੈ ਬੱਚੇ ਦੇ ਜਨਮ ਤੋਂ ਬਾਅਦ ਛੋਟੇ ਬੱਚੇ ਦੀ ਜਾਂਚ ਕਰਨੀ ਚਾਹੀਦੀ ਹੈ ਉਹਦੀ ਅੱਖ ਨੱਕ ਅਤੇ ਪਿੱਲੀਆਂ ਦੀ ਵਗੈਰਾ ਦੀ ਜਾਂਚ ਕਰਨੀ ਚਾਹੀਦੀ ਹੈ ਛੋਟੇ ਬੱਚੇ ਨੂੰ ਜਦੋਂ ਅਸੀਂ ਚੱਕਣਾ ਹੈ ਤਾਂ ਉਹਦੇ ਗਰਦਨ ਅਤੇ ਸਿਰ ਦੇ ਪਿੱਛੇ ਹੱਥ ਰੱਖ ਕੇ ਚੱਕਣਾ ਹੈ ਤਾਂ ਕਿ ਉਸ ਨੂੰ ਕਿਸੇ ਪ੍ਰਕਾਰ ਦੀ ਦਰਦ ਨਾ ਹੋਵੇ ਛੋਟੇ ਬੱਚੇ ਨੂੰ ਹਮੇਸ਼ਾ ਕੱਚ ਦੀ ਬੋਤਲ ਵਿੱਚ ਦੁੱਧ ਦੇਣਾ ਚਾਹੀਦਾ ਹੈ ਕੱਚ ਦੀ ਬੋਤਲ ਵਿੱਚ ਦੁੱਧ ਦੇਣਾ ਚਾਹੀਦਾ ਹੈ ਅਤੇ ਛੋਟੇ ਬੱਚੇ ਨੂੰ ਜਦੋਂ ਸਾਹ ਲੈਣ 'ਚ ਉਹਦੀ ਜਾਂਚ ਕਰਨੀ ਚਾਹੀਦੀ ਹੈ ਉਹਨੂੰ ਸਾਹ ਲੈਣ 'ਚ ਕੋਈ ਪ੍ਰੋਬਲਮ ਨਾ ਹੋਵੇ ਇਹ ਛੋਟੇ ਬੱਚੇ ਦੀ ਚੌਵੀ ਘੰਟਿਆਂ ਬਾਅਦ ਉਹਦੇ ਜਨਮ ਤੋਂ ਚੌਵੀ ਘੰਟਿਆਂ ਬਾਅਦ ਉਹਨੂੂੰ ਨਹਾਉਣਾ ਚਾਹੀਦਾ ਹੈ ਅਤੇ ਛੋਟੇ ਬੱਚਿਆਂ ਨੂੰ ਇੱਕ ਸਾਲ ਤੱਕ ਕੋਈ ਹੋਰ ਵਸਤੂ ਨਹੀਂ ਦੇਣੀ ਚਾਹੀਦੀ ਉਹਨੂੰ ਉਸ ਦੀ ਮਾਂ ਦਾ ਦੁੱਧ ਹੀ ਸਭ ਤੋਂ ਲਾਭ ਜ਼ਿਆਦਾ ਦਿੰਦਾ ਹੈ